ਹੈਲੋ ਸਤਿ ਸ਼੍ਰੀ ਅਕਾਲ ਸਰ ਮੈਨੂੰ ਮੇਰੇ ਮਿੱਤਰ ਨੇ ਉਹ ਨੰਬਰ ਦਿੱਤਾ ਸੀਗਾ ਜੀ ਮੈਂ ਕਾਰ ਲੈਣੀ ਸੀਗੀ ਮੈਂ ਦਿੱਲੀ ਤੋਂ ਬੋਲਦਾ ਹਾਂਜੀ ਦਿੱਲੀ ਨੰਬਰ ਚਾਹੀਦਾ ਦਿੱਲੀ ਨੰਬਰ ਚਾਹੀਦਾ ਹਾਂਜੀ ਹਾਂਜੀ ਆਈ ਟਵੈਂਟੀ ਦਾ ਕੀ ਉਹ ਏ ਹਾਂਜੀ ਹੋਰ ਕਿਹੜੀ ਗੱਡੀ ਹੈ ਹੋਰ ਕਿਹੜੀ ਗੱਡੀ ਹੈ ਸਰ ਜੀ ਬਰੈਜਾ ਬਰੈਜਾ ਦਾ ਕੀ ਉਹ ਏ ਹਾਂਜੀ ਉਹਦੀ ਇੰਸ਼ੋਰੈਂਸ ਵਗੈਰਾ ਹੋਈ ਵੀ ਹੈ ਜੀ ਇੰਸ਼ੋਰੈਂਸ ਵਗੈਰਾ ਹਾਂਜੀ ਅਤੇ ਕਿਹੜਾ ਮਾਡਲ ਹੈ ਜੀ ਹਾਂਜੀ ਠੀਕ ਹੈ ਜੀ ਅਤੇ ਉਹਦੀ ਕੰਡੀਸ਼ਨ ਬਿਲਕੁਲ ਸਹੀ ਏ ਨਾ ਮਤਲਬ ਕਿ ਅੰਦਰੋਂ ਬਾਹਰੋਂ ਹਾਂਜੀ ਹਾਂਜੀ ਉਹਦੇ ਠੀਕ ਹੈ ਓਕੇ ਠੀਕ ਹੈ ਵੀਰ ਜੀ